ਪੰਜਾਬੀ ਭਾਸ਼ਾ ਦਾ ਇਤਿਹਾਸ ਕੋਈ ਬਹੁਤ ਜ਼ਿਆਦਾ ਲੰਬਾ ਸਮਾਂ ਪੁਰਾਣਾ ਨਹੀਂ ਹੈ ਇਹ ਭਾਸ਼ਾ ਪੰਜਾਬ ਦੇ ਵਿੱਚ ਅਜੋਕੇ ਸਮੇਂ ਦੇ ਵਿੱਚ ਜੋ ਕਿ ਬੋਲੀ ਜਾਂਦੀ ਹੈ ਔਰ ਪਾਕਿਸਤਾਨ ਦੇ ਵਿੱਚ ਵੀ ਕੁਛ ਲਹਿੰਦੇ ਇਲਾਕਿਆਂ ਦੇ ਵਿੱਚ ਪੰਜਾਬੀ ਭਾਸ਼ਾ ਜੋ ਹੁਣ ਬੋਲੀ ਜਾ ਰਹੀ ਹੈ ਪੰਜਾਬ ਦੇ ਵਿੱਚ ਵੀ ਜਿਹੜੀ ਕਿ ਇਹ ਮੇਨ ਤਿੰਨ ਖਿੱਤਿਆਂ 'ਚ ਮਾਝਾ ਮਾਲਵਾ ਅਤੇ ਦੁਆਬਾ ਖਿੱਤੇ ਦੇ ਵਿੱਚ ਬੋਲੀ ਜਾਂਦੀ ਹੈ ਇਹ ਭਾਸ਼ਾ ਅਰਾਮ ਨਾਲ ਪਹਿਲੇ ਸਮੇਂ ਦੇ ਵਿੱਚ ਨਹੀਂ ਸੀ ਬੋਲੀ ਜਾਂਦੀ ਪੰਜਾਬ ਦੇ ਪਹਿਲੇ ਸਮਿਆਂ ਦੇ ਵਿੱਚ ਨਹੀਂ ਸੀ ਬੋਲੀ ਜਾਂਦੀ ਪੁਰਾਤਨ ਸਮੇਂ ਦੇ ਵਿੱਚ ਪੰਜਾਬ ਵਿੱਚ ਉੜਦੂ ਫਾਰਸੀ ਸੰਸਕ੍ਰਿਤ ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ ਪੰਜਾਬੀ ਭਾਸ਼ਾ ਦਾ ਵਿਕਾਸ ਸਿੱਖਾਂ ਦੇ ਗੁਰੂ ਨਾਨਕ ਦੇਵ ਜੀ ਤੋਂ ਪਹਿਲੀ ਪਾਤਸ਼ਾਹੀ ਤੋਂ ਸ਼ੁਰੂ ਹੋਈ ਉਹਨਾਂ ਨੇ ਧੁਰ ਕੀ ਬਾਣੀ ਉਚਾਰੀ ਜਿਸ ਨੂੰ ਕਿ ਸਿ ਸਿੱਖਾਂ ਦੇ ਦੂਸਰੇ ਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਇਸ ਭਾਸ਼ਾ ਨੂੰ ਇਕੱਤਰ ਕਰਕੇ ਇੱਕ ਵਰਣਮਾਲਾ ਪੰਜਾਬੀ ਬਣਾਈ ਜਿਸ ਨੂੰ ਆ ਅਸੀਂ ਊੜਾ ਐੜਾ ਦੇ ਰੂਪ ਦੇ ਵਿੱਚ ਜਾਣਦੇ ਹਾਂ ਸਾਰੇ ਇਸ ਵਰਣਮਾਲਾ ਨੂੰ ਪੈਂਤੀ ਅੱਖਰੀ ਵੀ ਬੋਲਿਆ ਜਾਂਦਾ ਹੈ ਜਿਸ ਤੋਂ ਬਾਅਦ ਇਸ ਭਾਸ਼ਾ ਦਾ ਵਿਕਾਸ ਹੋਇਆ ਅਤੇ ਗੁਰੂ ਮਹਾਰਾਜ ਨੇ ਬਾਕੀ ਗੁਰੂ ਸਾਹਿਬਾਂ ਨੇ ਜਿਹੜੀ ਬਾਣੀ ਉਚਾਰੀ ਉਹ ਸਾਰੀ ਗੁਰੂ ਮਹਾਰਾਜ ਨੇ ਆਦਿ ਗ੍ਰੰਥ ਦੇ ਵਿੱਚ ਲਿਖੀ ਦਰਜ ਕੀਤੀ ਜੋ ਕਿ ਅਜੋਕੇ ਸਮੇਂ ਸਾਡੇ ਸਾਰਿਆਂ ਨੂੰ ਪੜ੍ਹਨ ਔਰ ਲਿਖਣ ਨੂੰ ਮਿਲਦੀ ਹੈ ਉਸ ਤੋਂ ਬਾਅਦ ਇਸ ਦਾ ਵਿਕਾਸ ਪੰਜਾਬ ਦੇ ਅਲੱਗ ਅਲੱਗ ਖਿੱਤਿਆਂ ਦੇ ਵਿੱਚ ਮਸ਼ਹੂਰ ਹੋਇਆ ਬਾਅਦ ਵਿੱਚ ਅਜੋਕੇ ਸਮੇਂ ਦੇ ਵਿੱਚ ਅਸੀਂ ਸਾਰੇ ਹੀ ਪੰਜਾਬੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਜਿਵੇਂ ਕਿ ਅੱਜ ਕੱਲ੍ਹ ਦੇ ਸਰਕਾਰੀ ਦਫਤਰਾਂ ਸਰਕਾਰੀ ਸਕੂਲਾਂ ਆਮ ਬੋਲ ਚਾਲ ਦੀ ਭਾਸ਼ਾ ਹਰੇਕ ਜਗ੍ਹਾ ਅਸੀਂ ਪੰਜਾਬੀ ਨੂੰ ਹੀ ਬੋਲਦੇ ਪੜ੍ਹਦੇ ਸੁਣਦੇ ਅਤੇ ਲਿਖਦੇ ਹਾਂ